ਕਿਤਾਬਾਂ ਤੋਂ ਇਲਾਵਾ ਮੈਂ ਹੋਰ ਵੀ ਬਹੁਤ ਮਗ ਮੈਗਜੀਨ ਬਲਾਕ ਅਤੇ ਅਖ਼ਬਾਰਾਂ ਵੀ ਪੜ੍ਹਨ ਦੀ ਚਾਹਵਾਨ ਹਾਂ ਜਿਵੇਂ ਕਿ ਅਖ਼ਬਾਰ ਸਵੇਰੇ ਉੱਠਦੇ ਹੀ ਮੈਂ ਹੱਥਾਂ ਵਿੱਚ ਫੜ ਲੈਂਦੀ ਹਾਂ ਮੇਰਾ ਮਨਪਸੰਦ ਅਖ਼ਬਾਰ ਜਗ ਬਾਣੀ ਪੰਜਾਬੀ ਦਾ ਹੈ ਅਤੇ ਮੈਂ ਉਸ ਵਿੱਚ ਬਹੁਤ ਹੀ ਜਾਣਕਾਰੀ ਲੈਣ ਦੀ ਚਾਹਵਾਨ ਹੁੰਦੀ ਹਾਂ ਜਿਵੇਂ ਕਿ ਮੈਂ ਇਸ ਵੱਲ ਵੀ ਪੜ੍ਹ ਰਹੀ ਸੀ ਕਿ ਰਾਮ ਮੰਦਿਰ ਦੀ ਅਯੋਜਨਾ ਜਿਹੜੀ ਹੈ ਉਹ ਬਾਈ ਜਨਵਰੀ ਨੂੰ ਕੀਤੀ ਗਈ ਸੀ ਜੋ ਕਿ ਸਾਡੇ ਦੇਸ਼ ਦੇ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਦੀ ਪ੍ਰਾਨ ਪ੍ਰਤੀਸ਼ਠਾ ਜਿਹੜੀ ਹੈ ਉਹ ਕੀਤੀ ਅਤੇ ਬਹੁਤ ਇਹ ਖੁਸ਼ੀ ਵਾਲੀ ਗੱਲ ਹੈ ਕਿ ਸਹਾਨ ਸਾਨੂੰ ਆਪਣੇ ਧਰਮ ਦੇ ਪ੍ਰਤੀ ਜਿਹੜਾ ਹੈ ਉਹ ਅੱਗੇ ਵਧਣਾ ਚਾਹੀਦਾ ਹੈ